ਸਾਲਾਨਾ ਯਾਤਰਾ ਮੇਲਾ ਅਗਸਤ ਵਿੱਚ ਲੱਗਦਾ ਹੈ ਇਸ ਦੇ ਦੌਰਾਨ ਵਰਥੀ ਮੈਂ ਆਪਣੀ ਇੱਕ ਬਚਪਨ ਦੀ ਯਾਦ ਸਾਂਝੀ ਕਰਨਾ ਚਾਹਵਾਂਗੀ ਜਦ ਮੈਂ ਛੋਟੀ ਸੀ ਉਸ ਟਾਇਮ ਮੈਂ ਆਪਣੇ ਬਚਪਨ ਦੇ ਵਿੱਚ ਪਾਣੀ ਦੀ ਸੇਵਾ ਅਤੇ ਲੰਗਰ ਦੀ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਮੌਜੂਦ ਰਹਿੰਦੀ ਸੀ ਮੇਰੇ ਘਰ ਦੇ ਇਸ ਦੌਰਾਨ ਲੰਗਰ ਲਾਉਂਦੇ ਸਨ ਅਤੇ ਅਸੀਂ ਪਾਣੀ ਦੀ ਸੇਵਾ ਕਰਦੇ ਸਨ